ਹੈਲੋ ਹਾਂਜੀ ਕੋਣ ਬੋਲ ਰਿਹਾ ਜੀ ਹ ਹਾਂਜੀ ਸ਼ਰਮਾ ਫੁਟਵੀਅਰ ਤੋਂ ਸ਼ੋਪ ਤੋਂ ਬੋਲ ਰਹੇ ਜੀ ਹਾਂਜੀ ਇੱਕ ਆਪਣੀ ਮੈਰਜ ਸੀ ਬੇਟੇ ਦੀ ਉਹਦੇ ਵਾਸਤੇ ਆਪਾਂ ਨੂੰ ਸੂਜ਼ ਚਾਹੀਦੇ ਸੀਗੇ ਹਾਂਜੀ ਇੱਕ ਤਾਂ ਸ਼ ਸ਼ੂਜ਼ ਤਾਂ ਜੀ ਕੋਟ ਪੈਂਟ ਕੋਟ ਪੈਂਟ ਨਾਲ ਪਾਉਣ ਵਾਸਤੇ ਚਾਹੀਦੇ ਆ ਇੱਕ ਸ਼ੇਰਵਾਨੀ ਵਾਸਤੇ ਕੋਈ ਜੁੱਤੀ ਜੁੱਤੀ ਮਿਲ ਜਵੇ ਜੀ

ਠੀਕ ਹੈ ਜੀ ਠੀਕ ਹੈ ਜੀ ਠੀਕ ਠੀਕ ਠੀਕ ਠੀਕ ਹੈ ਸਰ ਠੀਕ ਹੈ ਸਰ ਲ਼ ਲੇਡੀਜ਼ ਵੀ ਨੇ ਨਾ ਠੀਕ ਹੈ

ਹਾਂਜੀ ਆਪਾਂ ਨੂੰ ਨੰਬਰ ਮਿਲਿਆ ਸੀ ਆਪਣੇ ਗਵਾਂਢ 'ਚ ਉਹਨਾਂ ਨੇ ਲੈ ਗਏ ਆਪਣੀ ਸ਼ੋਪ ਪਹਿਲਾਂ ਉਹਨਾਂ ਨੇ ਦਿੱਤਾ ਸੀ ਨੰਬਰ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਜੀ ਠੀਕ ਓਕੇ ਜੀ ਹਾਂਜੀ ਠੀਕ ਹੈ ਸਰ ਆਪਣੀ ਸ਼ੋਪ ਦਾ ਅਡਰੈਸ ਦੱਸਦੋ ਅਸੀਂ ਕੱਲ੍ਹ ਆਵਾਂਗੇ ਤੁਹਾਡੇ ਕੋਲ ਜੀ ਹਾਂਜੀ ਠੀਕ ਹੈ ਸਰ ਆਪਾਂ ਜ ਠੀਕ ਹੈ ਆਪਾਂ ਨੂੰ ਇਹਦੇ ਵਾਸਤੇ ਰੇਟ ਦਾ ਨੀ ਹੈ ਚੱਕਰ ਆਪਾਂ ਨੂੰ ਬਸ ਵਧੀਆ ਕੁਆਲਿਟੀ ਚਲਣ ਵਾਲੀ ਚੀਜ਼ ਚਾਹੀਦੀ ਹੈ ਹਾਂਜੀ

ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਸਰ ਜੀ ਜਿਹੜੇ ਛੋਟੇ ਬੱਚੇ ਆਪਣੇ ਦਸ ਸਾਲ ਤੋਂ ਛੋਟੇ ਛੋਟੇ ਬੱਚਿਆਂ ਵਾਲੇ ਵੀ ਆਪਣੇ ਕੋਲ ਅਵੇਲੇਵਲ ਹੈ ਠੀਕ ਹੈ ਜੀ ਹਾਂਜੀ

ਠੀਕ ਹੈ ਸਰ ਥੈਂਕ ਯੂ ਜੀ ਕੱਲ੍ਹ ਆਏ ਆ ਜੀ ਓਕੇ ਥੈਂਕ ਯੂ